ਸਿਹਤ ਸੰਭਾਲ ਖੇਤਰ ਵਿੱਚ ਭ੍ਰਿਸ਼ਟਾਚਾਰ ਤੋਂ ਮੈਂ ਜਾਣੂ ਹਾਂ ਕਿਉਂਕਿ ਜਿਹੜਾ ਇਹ ਭ੍ਰਿਸ਼ਟਾਚਾਰ ਆ ਇਹ ਬੜਾ ਮੈਡੀਕਲ ਲਾਇਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੋਇਆ ਏ ਕਿਉਂਕਿ ਜਿਹੜੀਆਂ ਇਹ ਮੈਡੀਸਨਾਂ ਬਣਾਈਆਂ ਜਾਂਦੀਆਂ ਨੇ ਦਵਾਈਆਂ ਬਣਾਈਆਂ ਜਾਂਦੀਆਂ ਜਾਂਦੀਆਂ ਨੇ ਉਹਨਾਂ ਵਿੱਚ ਬਹੁਤ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਆ ਇੱਕ ਵਾਰ ਮੇਰੇ ਨਾਲ ਵੀ ਇਹ ਭਾਣਾ ਵਰਤਿਆ ਮੈਂ ਦਵਾਈ ਖਾਧੀ ਜਿਹਨੇ ਕਿ ਮੈਨੂੰ ਹੋਰ ਬਿਮਾਰ ਕਰ ਦਿੱਤਾ ਸਹੀ ਕਰਨ ਦੇ ਬਜਾਏ ਮੈਨੂੰ ਹੋਰ ਬਿਮਾਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਵੀ ਕੈਮੀਕਲ ਸਨ ਉਹ ਸਹੀ ਨਹੀਂ ਸਨ